ਮੈਂ ਇਕੱਤੀ ਦਸੰਬਰ ਨੂੰ ਮੀਸ਼ੋ ਐਪ ਤੋਂ ਲਾਲ ਰੰਗ ਦੀਆਂ ਚੂੜੀਆਂ ਔਡਰ ਕੀਤੀਆਂ ਡਿਲੀਵਰੀ ਲਈ ਮੈਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਗਿਆ ਸੀ ਮੇਰਾ ਮਨ ਬਹੁਤ ਉਦਾਸ ਹੋਇਆ ਮੈਂ ਦੋ ਹਫ਼ਤੇ ਤੱਕ ਵੇਟ ਕਰਦੀ ਰਹੀ ਦੋ ਹਫ਼ਤੇ ਬਾਅਦ ਆ ਜਿਹੜੀ ਮੀਸ਼ੋ ਐਪ ਦੇ ਦੁਆਰਾ ਮੈਨੂੰ ਚੂੜੀਆਂ ਦੀ ਜਿਹੜੀ ਡਿਲੀਵਰੀ ਕੀਤੀ ਗਈ ਅਤੇ ਜਦੋਂ ਮੈਂ ਪੈਕਿੰਗ ਦੇਖੀ ਪੈਕਿੰਗ ਬਹੁਤ ਜ਼ਿਆਦਾ ਬੁਰੇ ਤਰੀਕੇ ਨਾਲ ਕੀਤੀ ਹੋਈ ਸੀਗੀ ਅਤੇ ਚੂੜੀਆਂ ਦਾ ਜਿਹੜਾ ਸਾਈਜ਼ ਸੀ ਮੈਂ ਪੰਜ ਨੰਬਰ ਔਡਰ ਕੀਤਾ ਸੀ ਛੇ ਨੰਬਰ ਆ ਜਿਹੜਾ ਸਾਈਜ਼ ਪਹੁੰਚਿਆ ਮੇਰੇ ਕੋਲ ਅਤੇ ਚੂੜੀਆਂ ਦਾ ਜਿਹੜਾ ਰੰਗ ਆ ਉਹ ਵੀ ਪ੍ਰੋਪਰ ਲਾਲ ਰੰਗ ਦਾ ਨਹੀਂ ਸੀ ਬਹੁਤ ਹੀ ਭੱਦਾ ਜਿਹਾ ਰੰਗ ਸੀਗਾ ਅਤੇ ਬਹੁਤ ਹੀ ਦੇਖਣ ਦੇ ਵਿੱਚ ਕੱਚੀਆਂ ਚੂੜੀਆਂ ਸੀਗੀਆਂ ਮੇਰਾ ਮਨ ਇਹ ਚੀਜ਼ਾਂ ਦੇਖ ਕੇ ਬਹੁਤ ਜ਼ਿਆਦਾ ਉਦਾਸ ਹੋਇਆ ਅਤੇ ਫਿਰ ਮੈਂ ਰਿਟਰਨ ਕਰਨ ਬਾਰੇ ਸੋਚਿਆ ਰਿਟਰਨ ਕਰਨ ਦੇ ਲਈ ਉਹਨਾਂ ਨੇ ਮੈਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਸੀ ਵੀ ਇੱਕ ਹਫ਼ਤੇ ਦੇ ਵਿੱਚ ਅਸੀਂ ਤੁਹਾਡੇ ਤੋਂ ਰਿਟਰਨ ਲੈ ਜਾਂਗੇ ਜਦੋਂ ਕਿ ਉਹ ਦੋ ਤਿੰਨ ਹਫ਼ਤਿਆਂ ਬਾਅਦ ਮੇਰੇ ਤੋਂ ਰਿਟਰਨ ਲੈ ਕੇ ਗਏ ਤਾਂ ਮੇਰਾ ਜਿਹੜਾ ਇਹ ਐਕਸਪੀਰੀਅੰਸ ਆ ਚੂੜੀਆਂ ਖਰੀਦਣ ਦਾ ਬਹੁਤ ਜ਼ਿਆਦਾ ਗੰਦਾ ਐਕਸਪੀਰੀਅੰਸ ਰਿਹਾ